ਮੇਰੇ ਸ਼ਹਿਰ ਪਟਿਆਲਾ ਦੇ ਵਿੱਚ ਬਹੁਤ ਹੀ ਵਧੀਆ ਹਸਪਤਾਲ ਹਨ ਇੱਥੇ ਸਰਕਾਰੀ ਅਤੇ ਪ੍ਰਾਈਵੇਟ ਦੋਨੋਂ ਤਰ੍ਹਾਂ ਦੇ ਹਸਪਤਾਲ ਉਪਲੱਬਧ ਹਨ ਸਰਕਾਰੀ ਹਪਸ ਹਸਪਤਾਲਾਂ ਦੇ ਵਿੱਚ ਬਹੁਤ ਹੀ ਅੱਛੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ ਕੋਵਿਡ ਦੇ ਦੌਰਾਨ ਅ ਲੋਕਾਂ ਨੂੰ ਬਹੁਤ ਹੀ ਅੱਛੀ ਤਰ੍ਹਾਂ ਜਾਗਰੂਕ ਕੀਤਾ ਜਾ ਰਿਹਾ ਸੀ ਬਹੁਤ ਸਾਰੀਆਂ ਫ੍ਰੀ ਸਰਵਿਸਿਸ ਸਪਲਾਈ ਦਿੱਤ ਕੀਤੀਆਂ ਜਾ ਰਹੀਆਂ ਸਨ ਕੋਵਿਡ ਮਹਾਂਮਾਰੀ ਨੂੰ ਰੋਕਣ ਦੇ ਲਈ ਬਾਰ ਬਾਰ ਹਦਾਇਤਾਂ ਦਿੱਤੀਆਂ ਜਾ ਰਹੀਆਂ ਸਨ ਉਹਨਾਂ ਨੂੰ ਇੰਜੈਕਸ਼ਨ ਲਗਵਾਏ ਜਾ ਰਹੇ ਸੀ ਤੇ ਮਾਸਕ ਵੀ ਦਿੱਤੇ ਜਾ ਰਹੇ ਸੀ ਲੋਕਾਂ ਨੂੰ ਸਾਫ਼ ਸਫ਼ਾਈ ਦਾ ਧਿਆਨ ਰੱਖਣ ਲਈ ਪ੍ਰ ਪ੍ਰਮੋਟ ਕੀਤਾ ਜਾ ਰਿਹਾ ਸੀਗਾ ਸਾਡੇ ਦੇਸ਼ ਸਾਡੇ ਸ਼ਹਿਰ ਦੇ ਵਿੱਚ ਸਰਕਾਰੀ ਹਸਪਤਾਲ ਰਜਿੰਦਰਾ ਹਸਪਤਾਲ ਹੈ ਜਿਹਦੇ ਵਿੱਚ ਬਹੁਤ ਹੀ ਹੋਣਹਾਰ ਡੋਕਟਰਾਂ ਦੀ ਟੀਮ ਹੈ ਜੋ ਕਿ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਲੋਕਾਂ ਨੂੰ ਵਧੀਆ ਇਲਾਜ ਦਿੰਦੇ ਹਨ ਇੱਥੇ ਹਰ ਕਲਾਸ ਦੇ ਲੋਕੀਂ ਇਲਾਜ ਕਰਨ ਲਈ ਜਾ ਸਕਦੇ ਹਨ ਮੇਰਾ ਸਿਹਤ ਨੂੰ ਲੈ ਕੇ ਬਹੁਤ ਹੀ ਅੱਛਾ ਐਕਸਪੀਰੀਅੰਸ ਰਿਹਾ ਇੱਕ ਵਾਰ ਮੈਂ ਅ ਰਜਿੰਦਰਾ ਹੋਸਪਿਟਲ ਦੇ ਵਿੱਚ ਆਪਣਾ ਚੈੱਕਅਪ ਕਰਵਾਉਣ ਲਈ ਗਈ ਜਿੱਥੇ ਮੇਰੇ ਸਾਰੇ ਟੈਸਟ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਕੀਤੇ ਗਏ ਅਤੇ ਡਾਕਟਰ ਨੇ ਸਾਨੂੰ ਰੈਕੋਮੈਂਡ ਕੀਤਾ ਕਿ ਉਹ ਸਾਰੇ ਟੈਸਟ ਹਸਪਤਾਲ ਦੇ ਅੰਦਰ ਹੀ ਕੀਤੇ ਜਾਣਗੇ ਟੈਸਟਾਂ ਤੋਂ ਬਾਅਦ ਮੈਨੂੰ ਉਹਨਾਂ ਨੇ ਚੰਗੀ ਤਰ੍ਹਾਂ ਜਾਂਚਿਆ ਜਦੋਂ ਮੇਰੀ ਜਾਂਚ ਚੱਲ ਰਹੀ ਸੀ ਆਲੇ ਦੁਆਲੇ ਦੀ ਬਹੁਤ ਹੀ ਵਧੀਆ ਸਫ਼ਾਈ ਸੀ ਅਤੇ ਡੋਕਟਰ ਨੇ ਮਾਸਕ ਪਾਇਆ ਹੋਇਆ ਸੀ ਅਤੇ ਮੈਨੂੰ ਵੀ ਮਾਸਕ ਪਾਉਣ ਦੇ ਲਈ ਕਿਹਾ ਗਿਆ ਮੈਂ ਕਹਿ ਸਕਦੀ ਹਾਂ ਕਿ ਮੇਰੇ ਸ਼ਹਿਰ ਦੇ ਸਰਕਾਰੀ ਹਸਪਤਾਲ ਬਹੁਤ ਹੀ ਵਧੀਆ ਹਨ